ਸਾਡੇ ਹਿੰਦੂ ਧਰਮ ਵਿੱਚ ਵਿਆਹ ਦੀ ਰਸਮ ਦਾ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਮੁੰਡਾ ਕੁੜੀ ਦੇਖੇ ਜਾ ਮੁੰਡੇ ਵਾਸਤੇ ਕੁੜੀ ਦੇਖੀ ਜਾਂਦੀ ਕੁੜੀ ਵਾਸਤੇ ਮੁੰਡਾ ਦੇਖਿਆ ਜਾਂਦਾ ਹੈ ਅਤੇ ਉਹਨਾਂ ਦੇ ਸਾਰੇ ਸੰਯੋਗ ਮਿਲਾਏ ਜਾਂਦੇ ਹਨ ਅਤੇ ਪੰਡਿਤ ਤੋਂ ਪੁੱਛਿਆ ਜਾਂਦਾ ਹੈ ਪੰਡਿਤ ਜੀ ਤੋਂ ਕਿ ਉਹਦੇ ਉਨ੍ਹਾਂ ਦੇ ਸੰਯੋਗ ਮਿਲਦੇ ਹਨ ਕਿਸ ਤਰ੍ਹਾਂ ਹਨ ਕਿਸ ਤਰ੍ਹਾਂ ਨਹੀਂ ਹਨ ਅਤੇ ਅੱਗੇ ਗੱਲ ਚਲਾਈ ਜਾਂਦੀ ਹੈ ਅਤੇ ਫਿਰ ਵਿਆਹ ਦੇ ਵਿੱਚ ਸੱਤ ਫੇਰੇ ਹੁੰਦੇ ਹਨ ਅਤੇ ਉਹਨਾਂ ਦੇ ਸੱਤ ਫੇਰਿਆਂ ਦੇ ਵਿੱਚ ਸੱਤ ਕਸਮਾਂ ਖਾਈਆਂ ਜਾਂਦੀਆਂ ਹਨ ਅਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਖਾਣ ਪਾਣ ਹੁੰਦਾ ਹੈ ਗੀਤ ਗੀਤ ਗਾਣ ਹੁੰਦਾ ਹੈ ਅਤੇ ਲੇਡੀ ਸੰਗੀਤ ਹੁੰਦਾ ਹੈ ਅਤੇ ਵਧੀਆ ਤਰੀਕੇ ਨਾਲ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ ਕੁੜੀਆਂ ਦੇ ਕੁੜੀ ਦੇ ਮਹਿੰਦੀ ਲਗਾਈ ਜਾਂਦੀ ਹੈ ਮੁੰਡੇ ਦੇ ਮਹਿੰਦੀ ਲਗਾਈ ਜਾਂਦੀ ਹੈ ਅਤੇ ਮੁੰਡੇ ਦੇ ਨੋਟਾਂ ਦੇ ਹਾਰ ਪਾਏ ਜਾਂਦੇ ਹਨ ਘੋੜੇ 'ਤੇ ਬਿਠਾਇਆ ਜਾਂਦਾ ਹੈ ਅਤੇ ਕੁੜੀ ਨੂੰ ਵਟਣਾਂ ਲਾਇਆ ਜਾਂਦਾ ਮੁੰਡੇ ਨੂੰ ਵੀ ਵਟਣਾਂ ਲਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਹੁੰਦੀਆ ਹਨ ਅਤੇ ਨਾਨਕ ਛੱਕ ਆਉਂਦੀ ਹੈ ਨਾਨਕੇ ਆਉਂਦੇ ਹਨ ਅਤੇ ਉਹ ਕੱਪੜਾ ਲੀੜਾ ਲੈ ਕੇ ਆਉਂਦੇ ਹਨ ਕੁੜੀ ਵਾਸਤੇ ਅਤੇ ਜਾਂ ਤਾਂ ਮੁੰਡੇ ਵਾਸਤੇ ਮਾਂ ਬਾਪ ਵੀ ਮੁੰਡਾ ਕੁੜੀ ਵਾਸਤੇ ਫਿਰ ਕੱਪੜੇ ਖਰੀਦਦੇ ਹਨ ਗਹਿਣੇ ਖਰੀਦੇ ਹਨ ਅਤੇ ਕੁੜੀ ਵਾਲੇ ਦਹੇਜ ਦੇਣ ਵਾਸਤੇ ਦੇਣ ਲੈਣ ਵਾਸਤੇ ਫਰਨੀਚਰ ਸਮਾਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਕੋਈ ਕਾਰ ਕੋਈ ਮੋਟਰਸਾਈਕਲ ਜੈਸਾ ਕਿ ਜਿੱਦਾਂ ਦੇਣਾ ਹੁੰਦਾ ਹੈ ਉਹ ਕਰਦੇ ਹਨ ਅਤੇ ਵਿਚੋਲੇ ਨੂੰ ਵੀ ਕੱਪੜੇ ਦਿੱਤੇ ਜਾਂਦੇ ਹਨ ਅਤੇ ਜਿੱਥੇ ਰਿੰਗ ਵੀ ਪਾਈ ਜਾਂਦੀ ਹੈ ਅਤੇ ਮੁੰਡੇ ਨੂੰ ਵੀ ਰਿੰਗ ਪਾਈ ਜਾਂਦੀ ਹੈ ਇਸ ਤਰ੍ਹਾਂ ਨਾਲ ਬਹੁਤ ਸਾਰੇ ਰੀਤੀ ਰਿਵਾਜ਼ ਹਨ ਜੋ ਮੁੰਡਾ ਕੁੜੀ ਦੇ ਵਿਆਹ ਦੇ ਵਿੱਚ ਕੀਤੇ ਜਾਂਦੇ ਹਨ